ਹੈਲ ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹਾਲ ਚਾਲ ਜੀ ਉਹ ਅ ਹਾਂਜੀ ਹਾਂਜੀ ਉਹ ਮੈਨੂੰ ਪਤਾ ਲੱਗ ਗਿਆ ਤੁਹਾਡਾ ਪੋਤਾ ਬਾਹਰ ਚੱਲ ਗਿਆ ਜੀ ਹੈ ਹਾਂ ਕਿਹੜਾ ਦੇਸ਼ ਗਿਆ ਜੀ ਅੱਛਾ ਅੱਛਾ ਫਿਰ ਤਾਂ ਬਾਹਲਾ ਪੈਸਾ ਲੱਗ ਗਿਆ ਹੋਣਾ ਜੀ ਹਾਂਜੀ ਮੇਰਾ ਮੇਰੀ ਵੀ ਪੋਤੀ ਗਈ ਸੀ ਜੀ ਪਿਛਲੇ ਸਾਲ ਕੰਮ ਕੁੰਮ ਤਾਂ ਉੱਥੇ ਵੀ ਇੱਦਾਂ ਦਾ ਹੀ ਹੈ ਚੱਲਦਾ ਜੀ ਪੰਜਾਬ ਨਾਲੋਂ ਥੋੜ੍ਹਾ ਜਿਹਾ ਠੀਕ ਹੈ ਜੀ ਹੈ ਜੀ ਹਾਂਜੀ ਇਹ ਤਾਂ ਕਹਿਣੀ ਪਉਗੇ ਇਹ ਗੱਲ ਮੰਨਣ ਵਾਲੀ ਹੈ ਜੀ ਇੱਧਰ ਦਾ ਜੀ ਨੌਕਰੀਆਂ ਨਿਕਲ ਨਹੀਂ ਰਹੀਆਂ ਮੇਰੀ ਕੁੜੀਆਂ ਨਾਲ ਈ ਇੱਥੇ ਜੀ ਐਮ ਐਸ ਸੀ ਐਮ ਐਡ ਕਰੀ ਹੋਈ ਸੀ ਸਾਰਾ ਕੁਝ ਕਰੇ ਨੌਕਰੀ ਓ ਨਹੀਂ ਮਿਲ ਰਹੀ ਸੀ ਜੀ ਕੱਢੇ ਨਹੀਂ ਰਹੀ ਜੀ ਸਰਕਾਰਾਂ ਜੇ ਕੱਢਦੀਆਂ ਤਾਂ ਥੋੜ੍ਹੀਆਂ ਕੱਢਦੀਆਂ ਅੱਛਾ ਜੀ ਹੋਰ ਇਹ ਕੱਢ ਨਹੀਂ ਰਹੀਆਂ ਜੀ ਸਰਕਾਰਾਂ ਪਹਿਲਾਂ ਵੀ ਪਹਿਲਾਂ ਇੱਦਾਂ ਤਾ ਵੀ ਪੰਜ ਸਾਲ ਬਾਅਦ ਕੱਢਦੀਆਂ ਹੁੰਦੀਆਂ ਤੀਆਂ ਹੁਣ ਵਾਲੀਆਂ ਨੇ ਇਹ ਕਰ ਲਿਆ ਵੀ ਕੱਢ ਤਾਂ ਰਹੀਆਂ ਪਰ ਕੱਢਦੀਆਂ ਹੀ ਤੁਪਕਾ ਤੁਪਕਾ ਹੈ ਬਸ ਦੋ ਸੌ ਕੱਢਤੀਆਂ ਸੌ ਕੱਢਤੀਆਂ ਦੇਣੇ ਵਾਲੇ ਹਜ਼ਾਰਾਂ 'ਚ ਹੈ ਜੀ ਹਜ਼ਰਾਂ ਕਿਆ ਲੱਖਾਂ 'ਚ ਹੈ ਜੀ ਹਾਂਜੀ ਹੋਰ ਜੀ ਬਾਕੀ ਦੇਖ ਲਓ ਆਹ ਕਤਲ ਕਿੰਨੇ ਹੋ ਰਹੇ ਆ ਪੰਜਾਬ 'ਚ ਨਿਆਣਿਆਂ ਨੇ ਤਾਂ ਭੱਜਣਾ ਹੀ ਆ ਬਾਹਰ ਨੂੰ ਜੀ ਬਾਕੀ ਫਿਰ ਤਿੰਨ ਸਾਲ ਇਹ ਉਹ ਕਰ ਰੱਖਦੇ ਆ ਕੋਈ ਤਨਖ਼ਾਹ ਨਹੀਂ ਦਿੰਦੇ ਹੈਗੇ ਹਾਂਜੀ ਪੜ੍ਹ ਲਿਖ ਕੇ ਨਾਲ ਗੁਜ਼ਾਰਾ ਚਲਦਾ ਘਰ 'ਚ ਸਰਕਾਰ ਨੂੰ ਪੁੱਛੇ ਹਾਂਜੀ ਹਾਂਜੀ ਹੋਰ ਬਹੁਤ ਕਾਂਪੀਟੀਸ਼ਨ ਹੈ ਜੀ ਤਾਂ ਹੀ ਮੈਂ ਆਪਣੀ ਪੋਤੀ ਨੂੰ ਬਾਹਰ ਭੇਜ ਤਾ ਜੀ ਊਂ ਠੀਕ ਰਹੀ ਕੰਮ ਥੋੜ੍ਹਾ ਜਿਹਾ ਘੱਟ ਮਿਲਦਾ ਚਲੋ ਠੀਕ ਜੇ ਆਪਣੇ ਜੋਗੇ ਕੱਢੀ ਜਾਂਦੀ ਆ ਹਾਂਜੀ ਹਾਂਜੀ ਚਲੋ ਐਂ ਹੈ ਜੀ ਘਰ ਦੇ ਗੁਜ਼ਾਰਾ ਚੱਲੀ ਜਾਵੇ ਪੀ ਆਰ ਪੂ ਆਰ ਤਾਂ ਆਪੇ ਹੋਈ ਜਾਂਦੀਆਂ ਹਾਂਜੀ ਹਾਂਜੀ ਤੁਹਾਡਾ ਬਰੈਂਮਟ ਨੂੰ ਗਈ ਹੈ ਜੀ ਫਿਰ ਤਾਂ ਠੀਕ ਆ ਮੇਰੀ ਪੋਤੀ ਵੀ ਬਰੈਂਮਟਨ ਏ ਗਈ ਹੈ ਉਹ ਆਹ ਫੂਡ ਸਟੋਰ ਜਿਹੇ ਵਿੱਚ ਲੱਗੀ ਹੋਈ ਆ ਜਿੱਥੇ ਪੀਜੇ ਪੂਜੇ ਜਿਹੇ ਨਹੀਂ ਬਣਦੇ ਹੁੰਦੇ ਜੀ ਪਹਿਲਾਂ ਕੋਲਜ ਜਾਂਦੀ ਆ ਫਿਰ ਉਹ ਪੀਜੇ ਸਟੋਰ 'ਚ ਜਾਂਦੀ ਆ ਫਿਰ ਜਾ ਕੇ ਘਰ ਰੋਟੀ ਬਣਾਉਂਦੀ ਹੈ ਟਾਈਮ ਕਿੱਥੇ ਉਹਦੇ ਕੋਲ ਆਹੀ ਉੱਥੇ ਕੰਮ ਬਹੁਤ ਆ ਜੀ ਪਹਿਲੇ ਦੋ ਤਿੰਨ ਸਾਲ ਤਾਂ ਇੱਥੇ ਇੰਡੀਆ 'ਚ ਜੇ ਨੌਕਰੀ ਜਿਹੀ ਮਿਲ ਜਾਂਦੀ ਨਾ ਫਿਰ ਤਾਂ ਵਧੀਆ ਹੀ ਨਜ਼ਾਰੇ ਤੇ ਇੱਥੇ ਤਾਂ ਚਲੋ ਤਨਖ਼ਾਹ ਤਾਂ ਥੋੜ੍ਹੀ ਬਹੁਤੀ ਸਹਾਰ ਵੀ ਹੋ ਜਾਂਦੀ ਘੱਟ ਵੱਧ ਹਾਂਜੀ ਇਹ ਤਾਂ ਗੱਲ ਦੇਖਣੀ ਪਉਂਗੀ ਇੱਥੇ ਜੋਬ ਦਾ ਥੋੜ੍ਹਾ ਜਿਹਾ ਕੰਮ ਔਖਾ ਹੀ ਚੱਲਦਾ

ਹਾਂਜੀ ਬੋਰ ਦਾ ਠੀਕ ਹੈ ਜੀ ਆਹ ਸਰਕਾਰਾਂ ਚਲੋ ਹੁਣ ਸਾਡੇ ਤਾਂ ਗਏ ਗਏ ਅਗਲਿਆਂ ਵਾਸਤੇ ਸਰਕਾਰਾਂ ਨੌਕਰੀਆਂ ਕੱਢੀ ਜਾਵੇ ਘੱਟੋ ਘੱਟ ਦਵੇ ਚਾਲੀ ਪੰਜਾਹ ਹਜ਼ਾਰ ਇਕੱਠੀਆਂ ਪਤਾ ਲੱਗੇ ਪੰਜਾਬ ਦੇ ਨਿਆਣਿਆਂ ਨੂੰ ਵੀ ਨੌਕਰੀਆਂ ਵੀ ਹੈਗੀਆਂ ਕੋਈ ਬਾਕੀ ਐਂ ਤਾਂ ਫਿਰ ਬਾਹਰ ਨੂੰ ਤਾਂ ਜਹਾਜ ਦੇ ਰੋਜ਼ ਏ ਚੜਦੇ ਹੈ ਹਾਂਜੀ ਇਹ ਤਾਂ ਗੱਲ ਹੈਗੀ ਆ ਚਲੋ ਠੀਕ ਆ ਜੀ ਫਿਰ ਮੈਂ ਫੋਨ ਰੱਖਦਾ ਜੀ ਫਿਰ ਤੁਹਾਡੇ ਘਰ ਆਉਂਗਾ ਜੀ ਮੈਂ ਇੱਕ ਦਿਨ ਫਿਰ ਤੁਹਾਡੇ ਘਰ ਆਏ ਗੱਲਬਾਤ ਕਰੁੰਗੇ ਹੁਣ ਫੋਨਾਂ ਪਰ ਤਾਂ ਐਡੀ ਲੰਬੀਆਂ ਕਹਾਣੀਆਂ ਪੈਂਦੀਆਂ ਨਹੀਂ ਠੀਕ ਹੈ ਧੰਨ